ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਫੁੱਲਾਂ ਵਾਸਤੇ ਪੁੱਛਣਾ ਸੀ ਆਪਣੇ ਲੜਕੇ ਦੀ ਮੈਰਿਜ ਆ ਉਹਦੇ ਵਾਸਤੇ ਵੀ ਕਿਹੜੇ ਫੁੱਲ ਵਧੀਆ ਹੋਣਗੇ ਤੇ ਉਹਦੇ ਵਾਸਤੇ ਜਾਣਕਾਰੀ ਲੈਣੀ ਸੀ ਹਾਂ ਉਹਦੇ ਵਾਸਤੇ ਥੋੜਾ ਵਿਸਤਥਾਰ ਨਾਲ ਮੈਨੂੰ ਦੱਸੋ ਵੀ ਕਿਹੜੇ ਫੁੱਲ ਆਪਾਂ ਵਿਆਹ ਵਾਸਤੇ ਘਰ ਦੀ ਸਜਾਵਟ ਵਾਸਤੇ ਹਾਂ ਉਹਦੀ ਚੀਜ਼ ਚਾਹੀਦੀ ਆ ਆਪਾਂ ਨੂੰ ਕਿ ਘਰ ਦੀ ਸਜਾਵਟ ਵਧੀਆ ਹੋ ਜੇ ਤੇ ਆਪਾਂ ਨੂੰ ਥੋੜੇ ਸਸਤੇ ਵੀ ਪੈਣ ਵਧੀਆ ਵੀ ਹੋਵੇ ਹਾਂ ਘਰੇ ਈ ਆ ਮੈ ਠੀਕ ਆ ਠੀਕ ਆ

ਦਰਮਿਆਨਾ ਜਾ ਆਪਾਂ ਨੂੰ ਉੱਨੇ ਕ ਫਿਰ ਮਤਲਬ ਕੀ ਰੇਂਜ 'ਚ ਪੈ ਜਾਣਗੇ ਫੁੱਲ ਠੀਕ ਆ ਤੇ ਸਾਨੂੰ ਇੱਕ ਹਫਤੇ ਤੱਕ ਲੋੜ ਆ ਉਦੋਂ ਤੱਕ ਰੇਜਮੈਂਟ ਹੋ ਜੂਗੀ ਤੇ ਆਪਣੇ ਡੋਨ ਡੋਨ ਪੇਮੈਂਟ ਪਹਿਲਾਂ ਕਿੰਨੀ ਜਮਾਂ ਕਰਵਾਉਣੀ ਪਊਗੀ ਫੁੱਲਾਂ ਦੇ ਨਾਲ ਨਾਲ ਹੋਰ ਵੀ ਕੁਝ ਆਪਾਂ ਨੂੰ ਵਧੀਆ ਕਰ ਸਕਦੇ ਕੋਈ ਲੜੀਆਂ ਵਗੈਰਾ ਕੋਈ ਹੋਰ ਕੁਝ ਵੀ ਠੀਕ ਆ ਠੀਕ ਆ ਹਾਂ ਬਸ ਵਧੀਆ ਇਹ ਉਸ ਹਫਤੇ ਤੱਕ ਆਪਾਂ ਨੂੰ ਹੈਗਾ ਵਿਆਹ ਦਾ ਉਦੋਂ ਆਪਾਂ ਪਹਿਲਾਂ ਪਹਿਲਾਂ ਜਿਹੜੇ ਜਰੂਰਤ ਹੈਗੀ ਆ ਤੇ ਉਹ ਹੋ ਜਾਵੇ ਅਸੀਂ ਇਧਰ ਮੋਗੇ ਆਲੀ ਤੋਂ ਈ ਬੋਲਦੇ ਆਂ ਸਾਨੂੰ ਜਿਆਦਾਤਰ ਤਾਂ ਗੁਲਾਬੀ ਤੇ ਚਿੱਟੇ ਫੁੱਲ ਦੀ ਲੋੜ ਹੈਗੀ ਆ ਥੀਮ ਜਿਹੜਾ ਨਾ ਆਪਣਾ ਜਿਹੜਾ ਥੀਮ ਆ ਉਹ ਗੁਲਾਬੀ ਜਾਂ ਚਿੱਟਾ ਉਹ ਹੋਵੇ ਉਹ ਵਧੀਆ ਰਹੂਗਾ

ਓਕੇ ਧੰਨਵਾਦ ਧੰਨਵਾਦ